ਇੱਕ ਜੂਨ ਉੱਨੀ ਸੌ ਸੱਤਰ ਉੱਨੀ ਸਤੰਬਰ ਉੱਨੀ ਸੌ ਸੱਠ ਅਠਾਰ੍ਹਾਂ ਦਸੰਬਰ ਦੋ ਹਜ਼ਾਰ ਪੰਜ ਤੇਰ੍ਹਾਂ ਨਵੰਬਰ ਦੋ ਹਜ਼ਾਰ ਤਿੰਨ ਅਤੇ ਦੋ ਅਪ੍ਰੈਲ ਉੱਨੀ ਸੌ ਅੱਸੀ